ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰ ਜੀ ਇੰਦਰਜੀਤ ਬੋਲਦਾ ਅਤੇ ਮੈਂ ਦੈਨਿਕ ਜਾਗਰਣ ਅਖ਼ਬਾਰ 'ਚ ਰਿਪੋਰਟਰ ਹਾਂ ਅਤੇ ਭਾਅ ਜੀ ਮੈਨੂੰ ਤੁਹਾਡਾ ਨੰਬਰ ਦਿੱਤਾ ਸੀ ਕਿਸੇ ਨੇ ਕਹਿੰਦੇ ਕਿ ਆ ਦਿਲਪ੍ਰੀਤ ਭਾਅ ਜੀ ਹੈਗੇ ਆ ਇਹਨਾਂ ਤੋਂ ਪੁੱਛ ਲਓ ਕਿ ਫਿਰੋਜ਼ਪੁਰ 'ਚ ਜਿਹੜੀਆਂ ਮਨ ਘੜਤ ਚੀਜ਼ਾਂ ਹੁੰਦੀਆਂ ਹੈ ਨਾ ਮਨ ਘੜਤ ਚੀਜ਼ਾਂ ਬਾਰੇ ਮੈਂ ਇੱਕ ਕਿਤਾਬ ਲਿਖਦਾ ਪਿਆ ਹਾਂ ਉਹਦੇ ਉੱਤੇ ਤੇ ਮੈਂ ਵੱਖ ਵੱਖ ਪੰਜਾਬ ਦੇ ਵੱਖ ਵੱਖ ਦੇ ਸ਼ਹਿਰਾਂ ਦੇ ਉੱਤੇ ਲਿਖ ਰਿਹਾ ਕਿ ਉਹਨਾਂ ਵਿੱਚ ਕਿਹੜੇ ਕਿਹੜੇ ਮਨ ਘਣਤ ਚੀਜ਼ਾਂ ਕੀਤੀਆਂ ਜਾਂਦੀਆਂ ਅਤੇ ਭਾਅ ਜੀ ਤੁਸੀਂ ਮੈਨੂੰ ਇਹਦੇ ਬਾਰੇ ਕੁਝ ਦੱਸੋ ਕਿ ਕੀ ਚੀਜ਼ਾਂ ਨੇ ਕਿਵੇਂ ਹੁੰਦੀਆਂ ਜਾਂ ਇਹਦੇ ਪਿੱਛੇ ਕੀ ਤੁੱਕ ਹੈ ਜੇ ਤੁੱਕ ਹੈਗੀ ਵੀ ਹੈ ਕਿ ਨਹੀਂ ਤੁੱਕ ਹੈਗੀ ਉਹਦੇ ਬਾਰੇ ਦੱਸੋ ਕੁਛ ਹਾਂਜੀ ਅੱਛਾ ਜੀ ਜੀ ਜੀ ਜੀ ਜੀ ਜੀ ਹਾਂਜੀ ਹਾਂਜੀ ਸਹੀ ਗੱਲ ਹੈ ਸਹੀ ਗੱਲ ਬਿਲਕੁਲ ਹਾਂਜੀ ਨਹੀਂ ਨਹੀਂ ਭਾਅ ਜੀ ਇਹ ਇਹ ਚੀਜ਼ ਇਹ ਚੀਜ਼ ਕਿਉਂ ਕਹੀ ਜਾਂਦੀ ਭਲਾ ਮਾਮਾ ਭਾਣਜਾ ਰਾਤ ਨੂੰ ਬਾਹਰ ਨਹੀਂ ਜਾ ਸਕਦੇ ਜਾਂ ਬਿਜਲੀ ਜਦੋਂ ਚਮਕੇ ਉੱਦੋਂ ਓਹ ਬਾਹਰ ਨਹੀਂ ਜਾ ਸਕਦੇ ਇਹ ਚੀਜ਼ ਕਿਉਂ ਕਹੀ ਜਾਂਦੀ ਹਾਂ ਅੱਛਾ ਜੀ ਨਹੀਂ ਕਿਉਂ ਡਿੱਗੂਗੀ ਤੁਹਾਨੂੰ ਕੀ ਲੱਗਦਾ ਇਹਦੇ ਬਾਰੇ ਕਿ ਭਰਮ ਹੀ ਹੈ ਕਿ ਇਹਦੇ ਵਿੱਚ ਕੋਈ ਤੁੱਕ ਹੈਗੀ ਹੈ ਅੱਛਾ ਜੀ

ਅੱਛਾ ਅੱਛਾ ਅਤੇ ਭਾਅ ਜੀ ਚਲੋ ਕੋਈ ਨਹੀਂ ਮੈਂ ਨਾ ਤੁਹਾਨੂੰ ਇੱਕ ਦਿਨ ਆ ਕੇ ਮਿਲਾਂਗਾ ਤੁਹਾਡੇ ਪਿੰਡ ਘਰੇ ਤੁਸੀਂ ਕਦੋਂ ਤੱਕ ਫਰੀ ਹੋਵੋਗੇ ਅੱਛਾ ਕੋਈ ਗੱਲ ਨਹੀਂ ਵੀਰ ਜੀ ਚਲੋ ਮੈਨੂੰ ਮਿਲਿਓ ਆਪਾਂ ਕੋਈ ਨਹੀਂ ਇਸ ਬਾਰੇ ਬਹਿ ਕੇ ਗੱਲ ਕਰਾਂਗੇ ਫਿਰ ਇਹ ਕੀ ਚੀਜ਼ ਹੈਗੀ ਹੈ ਠੀਕ ਹੈ ਜੀ ਓਕੇ ਬਾਏ ਜੀ ਓਕੇ ਓਕੇ